ਹੈਲੋ ਠੀਕ ਆ ਠੀਕ ਆ ਹੋਰ ਹਾਂਜੀ ਹਾਂਜੀ ਹਾਂਜੀ ਤੁਸੀਂ ਰੇਮਟੈਕਸ ਚ ਲੱਗੇ ਹੋਏ ਓ ਰੇਮਟੈਕਸ 'ਤੇ ਲੱਗੇ ਹੋਏ ਹੋ ਤੁਸੀਂ ਹਾਂ ਜੀ ਹਾਂ ਜੀ ਅੱਛਾ ਅੱਛਾ ਕਿਵੇਂ ਯਾਦ ਕੀਤਾ ਜੀ ਹਾਂਜੀ ਹਾਂਜੀ ਵਧੀਆ ਵਧੀਆ ਜੀ ਵਧੀਆ ਵਧੀਆ ਜੀ ਹਾਂਜੀ ਹਾਂ ਲੈ ਆ ਮੈਂ ਵੀ ਇਹ ਹੀ ਸੋਚਦਾ ਸੀਗਾ ਕਿ ਕਿਹੜਾ ਸਕੂਲ ਵਧੀਆ ਇਥੇ ਲੁਧਿਆਣੇ ਏਰੀਏ 'ਚ ਦੇਖੇ ਤਾਂ ਹੈਗੇ ਨੇ ਪਰ ਮੈਨੂੰ ਆਪ ਨਹੀਂ ਹੋਣਾ ਇਹ ਸਮਝ ਲੱਗ ਰਹੀ ਵੀ ਕਿਹੜੇ 'ਚ ਲਾਈਏ ਬਸ ਠੀਕ ਆ ਠੀਕ ਆ ਜੀ ਠੀਕ ਆ ਸਿਕਿਉਰਿਟੀ ਵਾਈਜ਼ ਬੱਚੇ ਠੀਕ ਆ ਠੀਕ ਆ ਅੱਛਾ ਚਲੋ ਵਧੀਆ ਫਿਰ ਤਾਂ ਨਾਲੇ ਨੇੜੇ ਹੋ ਤੁਸੀਂ

ਬਸ ਬਸ ਲੁਧਿਆਣਾ ਏਰੀਆ ਹੀ ਆਪਣਾ ਵੀ ਨੇੜੇ ਹੀ ਆ ਗਏ

ਆਪਾਂ ਜਾ ਆਉਂਦੇ ਹਾਂ ਸੋਮਵਾਰ ਫਿਰ ਨਾਲੇ ਪ੍ਰਿੰਸੀਪਲ ਹੋਰਾਂ ਨੂੰ ਮਿਲ ਆਉਂਦੇ ਹਾਂ ਜਾ ਕੇ ਹੀ ਪਤਾ ਲੱਗੂ ਕੋਈ ਨਾ ਮਿਲ ਲੈਂਦੇ ਨਹੀਂ ਨਹੀਂ ਕੋਈ ਨਾ ਜ਼ਰੂਰ ਚੱਲਾਂਗੇ ਕਿਉਂਕਿ ਇੱਕ ਦੋ ਸਕੂਲ ਦੇਖ ਕੇ ਹੀ ਪਤਾ ਲੱਗਣਾ ਮੈਂ ਆਪਣੇ ਗਿੱਲਾਂ ਨਨਕਾਣਾ ਪਬਲਿਕ ਸਕੂਲ ਇਹ ਵੀ ਵਧੀਆ ਹਾਂ ਹਾਂਜੀ ਹਾਂਜੀ ਹਾਂਜੀ ਪੁਰਾਣਾ ਸਕੂਲ ਆ ਠੀਕ ਆ ਠੀਕ ਆ ਵਧੀਆ ਸਕੂਲ ਆ ਇਹ ਹਾਂਜੀ ਹਾਂਜੀ ਹਾਂਜੀ

ਹਾਂ ਹਾਂ ਹਾਂ ਕੰਪੈਰੀਜ਼ਨ ਕਰ ਲਵਾਂਗੇ ਉਹਨਾਂ ਦਾ ਹਾਂ ਬਾਕੀ ਬੱਚੇ ਦਾ ਵੀ ਹੈ ਨਾ ਮਾਹੌਲ ਕਿਹੜਾ ਵਧੀਆ ਲੱਗਦਾ ਹਾਂ ਹਾਂ ਜੀ ਹਾਂ ਜੀ ਵਧੀਆ ਵਧੀਆ ਉਹ ਹੀ ਲਗਾਉਣਾ ਹੁਣ

ਨਹੀਂ ਤਾਂ ਫਿਰ ਪਤਾ ਹੀ ਹੋਣਾ ਸੀ ਆਪਾਂ ਨੂੰ ਦੂਜੇ ਦੀ ਲਾ ਦਿੰਦੇ ਫਿਰ ਜਿਹੜੇ 'ਚ ਪੜਦਾ ਹੁਣ ਉਹ ਹੀ

ਠੀਕ ਆ ਉੱਥੋਂ ਆਪਾਂ ਗੱਡੀ ਲੈ ਚੱਲਾਂਗੇ ਠੀਕ ਆ ਜੀ ਠੀਕ ਆ

ਬਿਲਕੁਲ ਬਿਲਕੁਲ ਹਾਂਜੀ ਹਾਂਜੀ ਬਸ ਠੀਕ ਆ ਜੀ ਫਿਰ ਤਾਂ ਗੱਲ ਬਣ ਗਈ ਬਿਲਕੁਲ ਬਿਲਕੁਲ ਚਲੋ ਕੋਈ ਨਾ ਫਿਰ ਆਪਾਂ ਫਿਰ ਮਿਲਦੇ ਹਾਂ ਬਸ ਆਪਾਂ ਹਾਂ ਰੱਖਾਂਗੇ ਰੱਖਾਂਗੇ ਠੀਕ ਆ ਜੀ ਹਾਂਜੀ ਹਾਂਜੀ ਵਧੀਆ ਓਕੇ ਜੀ